ਸਾਡੇ ਇਲਾਕੇ ਦੇ ਵਿੱਚ ਮੇਨ ਆਮਦਨ ਦਾ ਸਰੋਤ ਹੈਗਾ ਬਾਈ ਜ਼ਮੀਨ ਜ਼ਮੀਨ ਖਾਸੀ ਮਹਿੰਗੀ ਹੈ ਜ਼ਮੀਨ ਵਿਕਦੀ ਹੈ ਪੈਸੇ ਆਉਂਦੇ ਆ ਖਰਚ ਹੁੰਦੇ ਆ ਹੋਰ ਡੱਕਾ ਕੋਈ ਤੋੜ ਕੇ ਰਾਜੀ ਨਹੀਂ ਸਾਡੇ ਇਲਾਕੇ 'ਚ ਤਾਂ